ਸਤਿ ਸ਼੍ਰੀ ਅਕਾਲ ਜੀ ਤੁਸੀਂ ਬੋਟ ਕੋਂਪਨੀ ਤੋਂ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਮੈਂ ਪੰਦਰ੍ਹਾਂ ਕੁ ਦਿਨ ਪਹਿਲਾਂ ਤੁਹਾਡੀ ਐਪ ਤੋਂ ਇੱਕ ਹੈਡਫੋਨ ਔਰਡਰ ਕੀਤੇ ਸੀਗੇ ਤਾਂ ਫਿਰ ਮੈਂ ਉਹਦੇ ਬਾਰੇ ਤੁਹਾਨੂੰ ਆਪਣਾ ਜਿਹੜਾ ਸੀਗਾ ਐਕਸਪੀਰੀਐਂਸ ਦੱਸਣਾ ਸੀਗਾ ਕਿ ਜਿਹੜੇ ਮੈਂ ਤੁਹਾਡੇ ਐਪ ਦੇ ਥਰੂ ਜਿਹੜੇ ਔਰਡਰ ਕੀਤੇ ਸੀਗੇ ਹੈਡਫੋਨ ਮੈਂ ਕੀਤੇ ਸੀਗੇ ਬਲੈਕ ਕਲਰ ਦੇ ਔਰਡਰ ਕੀਤੇ ਸੀਗੇ ਬਟ ਜਿਹੜੇ ਮੈਨੂੰ ਘਰ ਮੈਨੂੰ ਮਿਲੇ ਹੈ ਉਹ ਸੀਗੇ ਕਰੀਮ ਕਲਰ ਦੇ ਉਹ ਇੱਕ ਤਾਂ ਇਹੀ ਸੀਗਾ ਕਿ ਵੀ ਮੇਰਾ ਕਲਰ ਬਹੁਤ ਹੀ ਜ਼ਿਆਦਾ ਡਿਫਰੈਂਟ ਆ ਗਿਆ ਸੀਗਾ ਅਤੇ ਦੂਸਰਾ ਇਹ ਵੀ ਸੀਗਾ ਕਿ ਮੈਂ ਔਰਡਰ ਜਦੋਂ ਕੀਤਾ ਉਹਦੇ ਵਿੱਚ ਲਿਖਿਆ ਸੀਗਾ ਕਿ ਮੈਨੂੰ ਪੰਜ ਦਿਨ ਦੇ ਵਿੱਚ ਵਿੱਚ ਮਿਲ ਜੇਗਾ ਪਰ ਜਿਹੜਾ ਮੇਰਾ ਔਰਡਰ ਸੀ ਉਹ ਮੈਨੂੰ ਪੂਰੇ ਪੰਦਰ੍ਹਾਂ ਦਿਨ ਲੇਟ ਮਿਲਿਆ ਲੇਟ ਮਿਲਣ ਦੇ ਬਾਅਦ ਵੀ ਜਿਹੜਾ ਡਿਲੀਵਰੀ ਮੈਨ ਸੀਗਾ ਉਹ ਮੇਰੇ ਤੋਂ ਐਕਸਟਰਾ ਚਾਰਜਿਸ ਮੰਗ ਰਿਹਾ ਸੀਗਾ ਜਦੋਂ ਕਿ ਮੈਂ ਤੁਹਾਡੀ ਐਪ ਦੇ ਥਰੂ ਆਪਣਾ ਸਾਰਾ ਜੋ ਸੀਗਾ ਮੇਰਾ ਪੇਮੈਂਟ ਦਾ ਭੁਗਤਾਨ ਕਰ ਚੁੱਕੀ ਸੀਗੀ ਅਤੇ ਜਦੋਂ ਮੈਂ ਉਹਨਾਂ ਹੈਡਫੋਨਸ ਨੂੰ ਘਰ ਵਰਤ ਕੇ ਦੇਖਿਆ ਤਾਂ ਉਹਨਾਂ ਦੇ ਵਿੱਚ ਜਿਹੜੀ ਆਵਾਜ਼ ਸੀਗੀ ਉਹ ਬਹੁਤ ਜ਼ਿਆਦਾ ਫਟੀ ਫਟੀ ਜਿਹੀ ਆ ਰਹੀ ਸੀਗੀ ਤਾਂ ਕਰਕੇ ਮੈਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਹੈ ਕਿਉਂਕਿ ਇੱਕ ਤਾਂ ਮੈਂ ਇੱਕ ਆਪਣੀ ਦੋਸਤ ਨੂੰ ਬਰਡੇ ਦੇ ਉੱਤੇ ਦੇ ਰਹੇ ਸੀਗੇ ਤਾਂ ਫਿਰ ਮੇਰਾ ਸਾਰਾ ਜਿਹੜਾ ਪਲੈਨ ਸੀਗਾ ਉਹ ਇੱਕ ਲੇਟ ਹੋਣ ਕਰਕੇ ਅਤੇ ਉਹ ਕੁਆਲਿਟੀ ਘਟੀਆ ਹੋਣ ਕਰਕੇ ਸਾਰਾ ਮੇਰੇ ਨਾਲ ਬਹੁਤ ਜ਼ਿਆਦਾ ਮੇਰੇ ਨਾਲ ਗਲਤ ਹੋਇਆ ਤਾਂ ਫਿਰ ਮੈਂ ਤੁਹਾਨੂੰ ਇਹ ਕਹੂੰਗੀ ਕਿ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਅਤੇ ਆਪਣੀ ਸੇਵਾਵਾਂ ਨੂੰ ਚੰਗਾ ਕੀਤਾ ਜਾਵੇ ਧੰਨਵਾਦ